ਇਸ ਸਾਲ ਜੂਨ ਦੀ ਛੁੱਟੀਆਂ ਦੇ ਵਿੱਚ ਇੱਕ ਜਗ੍ਹਾ ਪਹਾੜੀ ਸਫ਼ਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਹਦੇ 'ਚ ਰਿਸ਼ਤੇਦਾਰੀ ਦੇ ਵਿੱਚ ਵਿਆਹ ਸੀ ਜਿਹਦੇ ਵਿੱਚ ਕਾਫ਼ੀ ਟਰੈਵਲਿੰਗ ਵੀ ਕੀਤੀ ਰਿਸ਼ਤੇਦਾਰ ਨਾਲ਼ ਸੀ ਭੈਣ ਭਾਈ ਕਾਫ਼ੀ ਲੋਕ ਸੀ ਹੋਰ ਵੀ ਨਾਲ਼ ਅਤੇ ਅਸੀਂ ਇੱਥੋਂ ਬਿਲਾਸਪੁਰ ਹਿਮਾਚਲ ਪ੍ਰਦੇਸ਼ ਤੋਂ ਪਹਿਲਾ ਕਾਂਗੜੇ ਗਏ ਉੱਥੇ ਮੈਰਿਜ਼ ਸੀ ਕਾਂਗੜੇ ਤੋਂ ਬਰਾਤ ਜਾਣੀ ਸੀ ਜੀ ਚੰਬਾ ਪਹਿਲੇ ਦਿਨ ਅਸੀਂ ਕਾਂਗੜਾ ਰਹੇ ਪੂਰਾ ਆਨੰਦ ਮਾਨਿਆ ਅਗਲੇ ਦਿਨ ਅਸੀਂ ਚੰਬੇ ਲਈ ਗਏ ਉੱਥੇ ਚੰਬੇ ਦਾ ਪੂਰਾ ਸਫ਼ਰ ਦਿਨ ਹੈ ਜਿਹੜਾ ਪੂਰਾ ਸਫ਼ਰ ਦੇ ਵਿੱਚ ਲੰਘਿਆ ਸ਼ਾਮ ਨੂੰ ਜਾ ਕੇ ਅਸੀਂ ਇੱਥੇ ਚੰਬੇ ਪਹੁੰਚੇ ਰਾਤ ਦਾ ਵਿਆਹ ਸੀ ਰਾਤੀਂ ਬਾਰ੍ਹਾਂ ਵਜੇ ਜਿਹੜਾ ਹੈ ਵਿਆਹ ਖ਼ਤਮ ਹੋਇਆ ਅਸੀਂ ਆਪਣੇ ਆਪਣੇ ਠਿਕਾਣੇ 'ਤੇ ਜਾ ਕੇ ਸੋਏ ਸੋਏ ਹੀ ਸੀ ਕਿ ਬਾਰਿਸ਼ ਆ ਗਈ ਦੱਸਿਆ ਗਿਆ ਕਿ ਚੰਬੇ ਦੇ ਵਿੱਚ ਬਾਰਿਸ਼ ਕਿਸੇ ਟਾਈਮ ਵੀ ਹੋ ਸਕਦੀ ਹੈ ਅਤੇ ਉਹ ਪੂਰੀ ਰਾਤ ਬਾਰਿਸ਼ ਹੁੰਦੀ ਰਹੀ ਸਵੇਰੇ ਮੌਸਮ ਬਹੁਤ ਸੁਹਾਵਣਾ ਹੋ ਗਿਆ ਸਵੇਰੇ ਸਾਡੀ ਵਾਪਸੀ ਸੀ ਫਿਰ ਕਾਂਗੜੇ ਲਈ ਅਸੀਂ ਉੱਥੋਂ ਫਿਰ ਕਾਂਗੜੇ ਵਾਪਸ ਆਏ ਕਾਂਗੜੇ ਅਗਲੇ ਦਿਨ ਫਿਰ ਉਹਨਾਂ ਦੇ ਇੱਕ ਡਿਨਰ ਦਾ ਪ੍ਰੋਗਰਾਮ ਸੀ ਉਹ ਪ ਰਾਤ ਨੂੰ ਰਾਤੀਂ ਫਿਰ ਅਸੀਂ ਕਾਂਗੜੇ ਰਹੇ ਡਿਨਰ ਵਗੈਰਾ ਸੀ ਰਿਸ਼ਤੇਦਾਰ ਆਏ ਹੋਏ ਸੀ ਉਹਦੇ ਵਿੱਚ ਅਗਲੇ ਦਿਨ ਅਸੀਂ ਫਿਰ ਉੱਥੋਂ ਬ ਬਿਲਾਸਪੁਰ ਲਈ ਚਾਲੇ ਪਾਏ ਬਿਲਾਸਪੁਰ ਤੋਂ ਅਗਲੇ ਦਿਨ ਅਸੀਂ ਬਿਲਾਸਪੁਰ ਰਹੇ ਬਿਲਾਸਪੁਰ ਦੀ ਇੱਕ ਰਾਤ ਰਹਿਣ ਤੋਂ ਬਾਅਦ ਬਾਅਦ ਦੇ ਅਗਲੇ ਦਿਨ ਅਸੀਂ ਪਟਿਆਲੇ ਲਈ ਵਾਪਸ ਚੱਲੇ